ਪੰਜਾਬ ਵਿੱਚ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਇਸ ਤੋਂ ਪਹਿਲਾਂ ਘੱਟੋ ਘੱਟ ਦਸ ਦਿਨ ਪਹਿਲਾਂ ਪ੍ਰਭਾਤ ਫੇਰੀਆਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਪ੍ਰਭਾਤ ਫੇਰੀਆਂ ਵਿੱਚ ਹਰ ਘਰ ਦੇ ਵਿੱਚ ਸੰਗਤ ਦੇ ਕੁਛ ਨੁਮਾਇੰਦੇ ਜਾਂ ਲੋਕ ਜਾਂਦੇ ਹਨ ਜੋ ਜਾ ਕੇ ਕੀਰਤਨ ਸ਼ਬਦ ਕੀਰਤਨ ਪੜ੍ਹਦੇ ਜਾਂਦੇ ਹਨ ਅਤੇ ਉਹਨਾਂ ਦੀ ਲੋਕ ਸੇਵਾ ਕਰਦੇ ਹਨ ਉਸ ਤੋਂ ਬਾਅਦ ਨਗ ਗੁਰਪੁਰਬ ਤੋਂ ਇੱਕ ਦਿਨ ਪਹਿਲਾਂ ਜਿਹੜੇ ਲੋਕ ਇਸਨੂੰ ਮਨਾ ਰਹੇ ਹੁੰਦੇ ਹਨ ਉਹ ਨਗਰ ਕੀਰਤਨ ਕੱਢਦੇ ਹਨ ਅਤੇ ਨਗਰ ਕੀਰਤਨ ਦੇ ਦੌਰਾਨ ਸਾਰੇ ਸ਼ਹਿਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਨਾਲ ਸੰਗਤਾਂ ਜਾਂਦੀਆਂ ਹਨ ਔਰ ਉਹਨਾਂ ਦੀ ਇਲਾਕਾ ਨਿਵਾਸੀ ਸੇਵਾ ਕਰਦੇ ਹਨ ਅਤੇ ਇਸ ਤਰੀਕੇ ਨਾਲ ਇਹ ਤਿਉਹਾਰ ਬੜੀ ਧੂਮਧਾਮ ਦੇ ਨਾਲ ਗੁਰਪੁਰਬ ਮਨਾਇਆ ਜਾਂਦਾ ਹੈ ਅਤੇ ਹਰ ਅ ਇਸ ਵਿੱਚ ਸ਼ਾਮਿਲ ਹੋਣ ਵਾਲੇ ਲੋਕ ਬਾਣੀ ਪੜ੍ਹਦੇ ਹਨ ਨਾ ਔਰ ਲੰਗਰ ਦੇ ਵਿੱਚ ਸੇਵਾ ਕਰਦੇ ਹਨ ਦੂਜਿਆਂ ਦੀ ਸੇਵਾ ਕਰਦੇ ਹਨ ਇਸ ਤਰੀਕੇ ਨਾਲ ਇਹ ਗੁਰਪੁਰਬ ਦਾ ਜੋ ਤਿਉਹਾਰ ਮਨਾਇਆ ਜਾਂਦਾ ਹੈ